ਅੱਜ ਦੇ ਸੰਸਾਰ ਵਿੱਚ ਪੰਜਾਬੀ ਭਾਸ਼ਾ ਨੂੰ ਇੰਨਾ ਵਧੀਆ ਨਹੀਂ ਗਿਣਿਆ ਜਾਂਦਾ ਹਰ ਦਫ਼ਤਰ ਆਫ਼ਿਸ ਦੇ ਵਿੱਚ ਅੰਗਰੇਜ਼ੀ ਔਰ ਹਿੰਦੀ ਨੂੰ ਤਰਜੀਹ ਦਿੱਤੀ ਜਾਂਦੀ ਹੈ ਵੱਧ ਤੋਂ ਵੱਧ ਸਕੂਲਾਂ ਵਿੱਚ ਵੀ ਇੰਗਲਿਸ਼ ਜਾਂ ਹਿੰਦੀ ਬੋਲੀ ਜਾਂਦੀ ਹੈ ਔਰ ਪੰਜਾਬੀ ਨੂੰ ਬਹੁਤ ਹੀ ਪਿਛੜਿਆ ਹੋਇਆ ਸਮਝਿਆ ਜਾਂਦਾ ਹੈ ਜੋ ਕਿ ਬਹੁਤ ਗ਼ਲਤ ਹੈ ਹਰੇਕ ਭਾਸ਼ਾ ਨੂੰ ਸਨਮਾਨ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਪੰਜਾਬੀ ਸਾਡੀ ਮਾਂ ਬੋਲੀ ਹੈ ਔਰ ਇਸ ਨੂੰ ਵੀ ਇੱਕ ਵੱਖਰੀ ਪਹਿਚਾਣ ਦਿੱਤੀ ਜਾਣੀ ਚਾਹੀਦੀ ਹੈ ਹੋਰ ਕਈ ਸਕੂਲਾਂ ਵਿੱਚ ਇੰਗਲਿਸ਼ ਔਰ ਹਿੰਦੀ ਬੋਲੀ ਜਾਂਦੀ ਹੈ ਔਰ ਪੰਜਾਬੀ ਬੋਲਣ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਂਦਾ ਹੈ ਜੋ ਵੀ ਪੰਜਾਬੀ ਬੋਲਦਾ ਹੈ ਉਹਨੂੰ ਬਹੁਤ ਪਿਛੜਿਆ ਹੋਇਆ ਸਮਝਿਆ ਜਾਂਦਾ ਹੈ ਜੋ ਕਿ ਬਹੁਤ ਗ਼ਲਤ ਹੈ ਇਸ ਕਰਕੇ ਪੰਜਾਬੀ ਬਹੁਤ ਹੀ ਉੱਤਮ ਔਰ ਵਧੀਆ ਭਾਸ਼ਾ ਹੈ ਇਸ ਨੂੰ ਬੋਲਣਾ ਪੜ੍ਹਨਾ ਲਿਖਣਾ ਸਿੱਖਣਾ ਚਾਹੀਦਾ ਹੈ ਔਰ ਬਾਕੀ ਭਾਸ਼ਾ ਦੀ ਤਰ੍ਹਾਂ ਇਸ ਭਾਸ਼ਾ ਨੂੰ ਵੀ ਬਹੁਤ ਹੀ ਮਾਣ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ ਜੋ ਕਿ ਅੱਜ ਸੰਸਾਰ ਵਿੱਚ ਨਹੀਂ ਦਿੱਤਾ ਜਾ ਰਿਹਾ